ਬਹੁਤ ਸਾਰੇ ਕਾਰਨ ਨੇ ਕਿ ਵਿਦਿਆਰਥੀ ਸਕੂਲ ਵਿੱਚ ਨਹੀਂ ਜਾ ਸਕਦੇ ਜਾਂ ਨਹੀਂ ਜਾ ਰਹੇ ਨਿਯਮਿਤ ਤੌਰ 'ਤੇ ਉਹਦਾ ਵੱਡਾ ਕਾਰਨ ਜੇ ਅਸੀਂ ਕਹੀਏ ਤਾਂ ਵੱਡਾ ਕਾਰਨ ਕਿ ਜਾਗਰੂਕਤਾ ਖ਼ਾਸ ਕਰਕੇ ਕੁਝ ਐਸੇ ਪਰਿਵਾਰ ਨੇ ਜਿਨ੍ਹਾਂ ਅੰਦਰ ਵਿੱਦਿਆ ਪ੍ਰਤੀ ਹਜੇ ਵੀ ਜਾਗਰੂਕਤਾ ਦੀ ਕਮੀ ਆ ਘਾਟ ਆ ਜਿਹਦੇ ਕਰਕੇ ਨੌਜਵਾਨਾਂ ਦੇ ਵਿੱਚ ਉਹ ਉਤਸ਼ਾਹ ਵਿੱਦਿਆ ਪ੍ਰਤੀ ਨਹੀਂ ਦੇਖਣ ਨੂੰ ਮਿਲਦਾ ਕੁਝ ਆਰਥਿਕ ਕਾਰਨ ਵੀ ਹੁੰਦੇ ਨੇ ਆਰਥਿਕ ਕਾਰਨਾਂ ਕਰਕੇ ਵੀ ਬੱਚੇ ਸਕੂਲਾਂ ਦੇ ਵਿੱਚ ਨਹੀਂ ਜਾ ਸਕਦੇ ਉਹਨਾਂ ਨੂੰ ਕਿਰਤ ਵੀ ਕਰਨੀ ਪੈਂਦੀ ਆ ਮਿਹਨਤ ਵੀ ਕਰਨੀ ਪੈਂਦੀ ਆ ਛੋਟੀਆਂ ਉਮਰਾਂ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਸਿਰ 'ਤੇ ਆ ਜਾਂਦੀਆਂ ਨੇ ਕਈ ਕਾਰਨ ਬਣ ਜਾਂਦੇ ਨੇ ਸੋ ਉਹਨਾਂ ਕਾਰਨਾਂ ਕਰਕੇ ਵੀ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਵਿੱਚ ਉਹ ਚੀਜ਼ ਘੱਟਦੀ ਆ ਪਰ ਵੱਡੀ ਗੱਲ ਜੇ ਕਹਿ ਲਈਏ ਜਾਗਰੂਕਤਾ ਜੇ ਜਾਗਰੂਕਤਾ ਹੋਵੇ ਵਿੱਦਿਆ ਪ੍ਰਤੀ ਕਿ ਵੀ ਵਿੱਦਿਆ ਕਿੰਨੀ ਕੁ ਤਾਕਤ ਰੱਖਦੀ ਹੈ ਕਿੰਨੀ ਅਹਿਮ ਆ ਸਾਡੇ ਲਈ ਤਾਂ ਫਿਰ ਬਾਕੀ ਸਾਰੇ ਜਿਹੜੇ ਕਾਰਨ ਉਹ ਸੈਕਿੰਡਰੀ ਹੋ ਜਾਂਦੇ ਆ ਗਾਉਣ ਹੋ ਜਾਂਦੇ ਆ ਅਹਿਮ ਜਿਹੜੀ ਆ ਫਿਰ ਮਨ ਦੇ ਵਿੱਚ ਇਹੀ ਗੱਲ ਕਿ ਵੀ ਵਿੱਦਿਆ ਹਾਸਿਲ ਕਰਨੀ ਉਹਦੇ ਲਈ ਉਤਸ਼ਾਹ ਪੈਦਾ ਕਰਨਾ ਬੜਾ ਅਹਿਮ ਆ ਬੱਚਿਆਂ ਦੇ ਵਿੱਚ ਜਾਂ ਵਿਦਿਆਰਥੀਆਂ ਦੇ ਵਿੱਚ ਉਸ ਲੈਵਲ ਤੱਕ ਦਾ ਜਾਂ ਉਸ ਪੱਧਰ ਦਾ ਉਤਸ਼ਾਹ ਨਹੀਂ ਪੈਦਾ ਕੀਤਾ ਜਾ ਰਿਹਾ ਅਧਿਆਪਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਮੀਆਂ ਨੇ ਜੇ ਅਧਿਆਪਕਾਂ ਦੇ ਵਿੱਚ ਵਿੱਦਿਆ ਨੂੰ ਪ੍ਰਸਾਰਨ ਦਾ ਇੱਕ ਜਜ਼ਬਾ ਹੋਵੇ ਇੱਕ ਸੋਹਣੇ ਢੰਗ ਦੀ ਵਿਉਂਤ ਹੋਵੇ ਤਾਂ ਵਿਦਿਆਰਥੀ ਖੁਦ ਬਾ ਖੁਦ ਸਕੂਲਾਂ ਵੱਲ ਖਿੱਚੇ ਜਾਣਗੇ ਵਿਦਿਆਰਥੀ ਚਾਹੁੰਣਗੇ ਕਿ ਹਾਂ ਮੈਂ ਕੁਛ ਸਿੱਖਣਾ ਅਤੇ ਮੈਂ ਸਕੂਲ ਜਾਣਾ ਹੀ ਜਾਣਾ